ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਆਪਣੇ ਪਟਿਆਲਾ ਸ਼ਹਿਰ ਵਿੱਚ ਬਾਲ ਮਜ਼ਦੂਰੀ ਆਪਣੇ ਆਲੇ ਦੁਆਲੇ ਵਿੱਚ ਅਤੇ ਟਰੈਫਿਕ ਲਾਈਟਾਂ ਉੱਤੇ ਦੇਖੀ ਹੈ ਕਈ ਮਾਂ ਬਾਪ ਜੋ ਗਰੀਬ ਹੁੰਦੇ ਹਨ ਉਹ ਆਪਣੇ ਬੱਚਿਆਂ ਨੂੰ ਬਾਲ ਮਜ਼ਦੂਰੀ ਵਾਲੇ ਪਾਸੇ ਲਾਉਂਦੇ ਹਨ ਜਿਵੇਂ ਕਿ ਟਰੈਫਿਕ ਲਾਈਟਾਂ ਉੱਤੇ ਭੀਖ ਮੰਗਣਾ ਦੁਕਾਨਾਂ ਉੱਤੇ ਮਜ਼ਦੂਰੀ ਕਰਨਾ ਕੰਮ ਕਰਨਾ ਇਸ ਨੂੰ ਸਰਕਾਰ ਵੱਲੋਂ ਅਤੇ ਲੋਕਾਂ ਦੀ ਮਦਦ ਵੱਲੋਂ ਰੋਕਿਆ ਜਾ ਸਕਦਾ ਹੈ ਸਰਕਾਰ ਨੂੰ ਐਵੇਂ ਦੀਆਂ ਕੁਝ ਪਾਲਸੀਆਂ ਲਿਆਉਣੀ ਚਾਹੀਦੀਆਂ ਹਨ ਤਾਂ ਜੋ ਬਾਲ ਮਜ਼ਦੂਰੀ ਨੂੰ ਰੋਕਿਆ ਜਾ ਸਕੇ ਅਤੇ ਇਸ ਦੇ ਉੱਪਰ ਬੈਨ ਲਾਇਆ ਜਾ ਸਕੇ ਸਰਕਾਰ ਵੱਲੋਂ ਅਜਿਹੀਆਂ ਪਾਲਸੀਆਂ ਲਿਆਉਣੀ ਚਾਹੀਦਾ ਹਨ ਕਿ ਜੋ ਵੀ ਬਾਲ ਮਜ਼ਦੂਰੀ ਕਰਵਾਵੇ ਉਸ ਨੂੰ ਬਹੁਤ ਹੀ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਕੁਝ ਨੌਕਰੀਆਂ ਜਿਵੇਂ ਕਿ ਮਜ਼ਦੂਰ ਦੁਕਾਨਾਂ ਉੱਤੇ ਮਜ਼ਦੂਰ ਟ ਟਰੈਫਿਕ ਲਾਈਟਾਂ ਉੱਤੇ ਬੱਚੇ ਅਤੇ ਜ਼ਿਆਦਾਤਰ ਮਜ਼ਦੂਰੀ ਵਾਲੀਆਂ ਨੌਕਰੀਆਂ ਹਨ ਜਿਸ ਵਿੱਚ ਬੱਚੇ ਖਿੱਚੇ ਜਾਂਦੇ ਹਨ ਉਹ ਵੱਧ ਕੰਮ ਕਰਕੇ ਵੀ ਘੱਟ ਪੈਸੇ ਕਮਾਉਂਦੇ ਹਨ ਇਸ ਲਈ ਸਰਕਾਰ ਨੂੰ ਅਤੇ ਮਾਂ ਬਾਪ ਨੂੰ ਆਪਣੇ ਅ ਯੋਗਤਾ ਯੋਗਤਾ ਅਨੁਸਾਰ ਸ ਕੰਮ ਕਰਨਾ ਚਾਹੀਦਾ ਹੈ ਤਾਂ ਜੋੋ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕਣ ਅਤੇ ਬਾਲ ਮਜ਼ਦੂਰੀ ਵਿੱਚ ਘੱਟ ਤੋਂ ਘੱਟ ਲਾਉਣ ਧੰਨਵਾਦ